ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲਦਾ ਅੱਛਾ ਹਾਂ ਦਿਲਜੀਤ ਬੜੇ ਦਿਨਾਂ ਬਾਅਦ ਫੋਨ ਕੀਤਾ ਭੈਣ ਕਿਵੇਂ ਆ ਅੱਛਾ ਕਿੱਥੋਂ ਲਿਤਾ ਅੱਛਾ ਨਹੀਂ ਮੈਂ ਵੀ ਕੋਲ ਤੁਹਾਡੇ ਕਿਸੇ ਦਾ ਨੰਬਰ ਨਹੀਂ ਹੈਗਾ ਮੈਂ ਤਾਂ ਬਸ ਵਿਆਹ ਹੋ ਗਿਆ ਸੀ ਤੇਰਾ ਪਹਿਲਾਂ ਹੋ ਗਿਆ ਮੇਰਾ ਬਾਅਦ 'ਚ ਹੋ ਗਿਆ ਵਿਆਹ ਹਾਂ ਹਾਂ ਹਾਂ ਕਰ ਲੂਗੀ ਮੈਂ ਘੋਲੀਏ ਪਿੰਡ 'ਚ ਨਾ ਕਿੱਥੇ ਲੱਗਦਾ ਹੈ ਸਾਰਾ ਦਿਨ ਬਸ ਘਰੇ ਬੈਠੀ ਰਹਿਦੀ ਆਗੀ ਨਾ ਜੀ ਲੱਗਦਾ ਆਪਾਂ ਸ਼ਹਿਰ ਵਾਲੇ ਆਪਣਾ ਪਿੰਡਾਂ 'ਚ ਕਿੱਥੇ ਜੀ ਲੱਗਦਾ ਉਹ ਤੋਂ ਕੋਈ ਚੀਜ਼ ਲਿਆਉਣੀ ਵੀ ਪੈਂਦੀ ਹੈਗੀ ਤਾਂ ਔਖਾ ਹੁੰਦਾ ਉਹ ਤਾਂ ਬੱਚਿਆਂ ਦੀ ਕੋਈ ਚੀਜ਼ ਲਿਆਉਣੀ ਤਾਂ ਔਖਾ ਹਮ ਉਹੀ ਕੱਲ੍ਹ ਰਾਤ ਵੇਸੇ ਤਾਂ ਬਿਮਾਰ ਹੋ ਅਤੇ ਸਾਨੂੰ ਤਾਂ ਸ਼ਹਿਰ ਭੱਜਣਾ ਪੈਂਦਾ ਜਵਾਕਾਂ ਨੂੰ ਖਾਂਸੀ ਜੁਕਾਮ ਹੋ ਜੇ ਹਾਂਜੀ ਹਮ ਹਮ ਉਹੀ ਤੈਨੂੰ ਤੈਨੂੰ ਤੁਹਾਨੂੰ ਤਾਂ ਨੇੜੇ ਆ ਮੈਨੂੰ ਤਾਂ ਜਦੋਂ ਜਵਾਕ ਰਾਤੀ ਬਿਮਾਰ ਹੋਏ ਹੁੰਦੇ ਆ ਜੇ ਉਹ ਭਾਫ ਦੂਣ ਜਾਣ ਡਾਕਟਰ ਨੂੰ ਸ਼ਹਿਰ ਜਾਣਾ ਪੈਂਦਾ ਅੱਧੀ ਰਾਤ ਉਤੋਂ ਹਨੇਰਾ ਅੱਜ ਕੱਲ੍ਹ ਮਾਹੌਲ ਨਹੀਂ ਸਹੀ ਸ਼ਹਿਰ ਸੀ ਸ਼ਹਿਰ ਚ ਤਾਂ ਟੈਨਸ਼ਨ ਫਰੀ ਜਿਥੋਂ ਮਰਜ਼ੀ ਚਲ ਜਾਓ ਕੋਈ ਮਰਜੀ ਚੀਜ਼ ਲਿਆਓ ਰਾਤ ਨੂੰ ਗਿਆਰਾਂ ਬਾਰਾਂ ਵਜੇ ਤੱਕ ਸਾਡਾ ਪਿੰਡ ਛੇ ਵਜੇ ਲੋਕ ਸੋ ਜਾਂਦੇ ਪਿੰਡ 'ਤੇ ਤਾਂ ਬਾਹਲਾ ਔਖਾ ਮੇਰਾ ਤਾਂ ਹਮ ਚਲਾ ਲਓ ਹਾਂ ਕੀ ਕੰਮ ਕਰਦੇ ਆ ਚਲੋ ਵਧੀਆ ਗੱਲ ਹੈ ਫਿਰ ਤਾਂ ਵਧੀਆ ਸ਼ਹਿਰਾਂ 'ਚ ਚੱਲ ਪੈਂਦਾ ਨਹੀਂ ਉਹ ਤਾਂ ਕਹਿੰਦੀ ਸ਼ਹਿਰ ਵਾਲੇ ਪਤਾ ਕੀ ਸ਼ਹਿਰਾਂ ਵਿੱਚ ਤਾਂ ਸਾਰੇ ਕਮਾਉਂਦੇ ਆ ਨਾਲੇ ਪੈਸੇ ਭਰ ਦਿੰਦਾ ਨਾਲੇ ਅਗਲਾ ਕਹਿੰਦਾ ਸਾਨੂੰ ਮਨਪਸੰਦ ਚੀਜ਼ ਬਣਾ ਕੇ ਦਿੰਦਾ ਸ਼ਹਿਰਾਂ 'ਚ ਟਰੈਂਡ ਲ ਪਿੰਡਾਂ ਵਿੱਚ ਤਾਂ ਫਰੀ ਵਿੱਚ ਭਾਲਦੀਆਂ ਹਮ ਹਮ ਹਮ ਬਹੁਤ ਵਧੀਆ ਹਮ ਸਾਡੇ ਤਾਂ ਪਿੰਡ ਦੇ ਵਿੱਚ ਇੱਕ ਮੈਡੀਕਲ ਉਹ ਵੀ ਕਦੇ ਖੁੱਲ੍ਹਦਾ ਕਦੇ ਖੁੱਲ੍ਹਦਾ ਨਹੀਂ ਕਿਹਾ ਤਾਂ ਸੀਗਾ ਮੈਂ ਬੱਚੇ ਤਾਂ ਸ਼ਹਿਰ ਹੀ ਲਾਏ ਆ ਸਕੂਲ ਉਹੀ ਤਾਂ ਔਖਾ ਬੱਚੇ ਸਕੂਲ ਦੀ ਵੈਨ ਆਉਂਦੀ ਬੱਚੇ ਦਾ ਸ਼ਹਿਰ ਹੀ ਹੈ ਹਮ ਹਮ ਹਮ ਹਮ ਹਮ ਹਮ ਅਤੇ ਸ਼ਹਿਰਾਂ ਵਿੱਚ ਬਹੁਤ ਸੌਖਾ ਸਾਰਾ ਕੁਝ ਤਾਂ ਮਿਲ ਜਾਣਾ ਸ਼ਹਿਰ 'ਚ ਸੌਖਾ ਨਾਲੇ ਕੁੜੀ ਦਾ ਦਾਜ ਦੂਜਾ ਕੱਪੜੇ ਗਹਿਣਾ ਗੱਟਾ ਸਾਰਾ ਇੱਥੋ ਬਣ ਜਾਣਾ ਹੈਗਾ ਬਾਹਰ ਜਾਣ ਦੀ ਲੋੜ ਹੀ ਨਹੀਂ ਹਾਂਜੀ ਫੇਰ ਆਉਂਦੀ ਆ ਹਾਂ ਹਮ ਹਮ ਹੋਰ ਮੈਨੂੰ ਤਾਂ ਬਾਹਲਾ ਔਖਾ ਹੁੰਦਾ ਸਮਾਨ ਲਿਆਉਣ ਦਾ ਹਾਂ ਮੈਂ ਇਹੀ ਕਹਿੰਦੀ ਪਿੰਡ ਤਾਂ ਬਸ ਸਾਨੂੰ ਬਸ ਸਾਨੂੰ ਪਿੰਡ ਦਾ ਇਹ ਸੌਖਾ ਕਿ ਸਾਨੂੰ ਜਿਹੜੇ ਵੀ ਸਬਜ਼ੀਆਂ ਸੁਬਜੀਆਂ ਬੀਜ ਸਾਨੂੰ ਘਰ ਦੀਆਂ ਮਿਲ ਜਾਂਦੀਆਂ ਬਸ ਇਹੀ ਸੌਖਾ ਹੋਰ ਕੋਈ ਸੁੱਖ ਨਹੀਂ ਮਿਲ ਜਾਂਦੀ ਆ ਨਹੀਂ ਹੁਣ ਬੱਚੇ ਸਕੂਲ ਵੀ ਪੜ੍ਹਦੇ ਆ ਹੁਣ ਉਹ ਵੱਡੀ ਕੁੜੀ ਮੇਰੀ ਬਾਰਾਂ ਕਰ ਜਾਊਗੀ ਕਾਲਜ ਲਾਣਾ ਹੁਣ ਇਹਨੂੰ ਸ਼ਹਿਰ 'ਚ ਭੇਜਣਾ ਹੁਣ ਰੋਜ਼ ਅਪ ਡਾਊਨ ਜਵਾਕ ਕਿੱਥੇ ਕਰੇਗਾ ਹੁਣ ਉੱਥੇ ਰਹੇਗੀ ਤਾਂ ਹੀ ਮੈਂ ਵੀ ਇਹਨਾਂ ਨੂੰ ਕਿਹਾ ਕਿ ਆਪਾਂ ਵੀ ਸ਼ਹਿਰ 'ਚ ਲੈ ਲਈਏ ਪਰ ਮੇਰੇ ਸੱਸ ਨਹੀਂ ਮੰਨਦੀ ਕਹਿੰਦੀ ਪਿੰਡ 'ਚ ਜੀ ਲੱਗਦਾ ਹਾਂ ਇਹ ਤਾਂ ਹੈ ਪਰ ਹੈ ਕਿ ਬਸ ਅੱਜ ਸ਼ਹਿਰ ਸਹੀ ਹੈ ਹਮ ਹਮ ਹਮ ਹਮ ਹਮ ਹਮ ਭਵਿੱਖ ਬਣਾਉਣਾ ਹਾਂ ਮਾਹੌਲ ਨਹੀਂ ਸਹੀ ਹੈਗਾ ਅੱਜ ਹੁਣ ਵੀ ਬੱਚੇ ਆਉਣ ਵਾਲੇ ਸਕੂਲੋਂ ਹੁਣ ਬੱਚੇ ਸਕੂਲੋਂ ਦੀ ਵੈਨ ਆਉਣ ਵਾਲੀ ਬਸ ਮੈਂ ਜਾਂਦੀ ਹਾਂ ਲੈਣ ਮੋੜ ਤੋਂ ਘਰ ਮੂਹਰੇ ਉਹ ਨਹੀਂ ਲਾ ਕੇ ਜਾਂਦਾ ਚਲ ਮੈਂ ਕਰਦੀ ਤੈਨੂੰ ਮੈਂ ਬੱਚਿਆਂ ਨੂੰ ਲਿਆਵਾਂ ਹਾਂਜੀ ਠੀਕ ਹੈ ਚਲੋ ਹਾਂ ਮੈਂ ਜ਼ਰੂਰ ਆਉਂ ਬੱਚੇ ਲਿਆਵਾਂ ਮੋੜ 'ਤੇ ਆ ਗਈ ਵੈਨ ਠੀਕ ਆ ਫਿਰ ਕਰਦੀ ਹਾਂ ਹਾਂ ਹਾਂ ਜ਼ਰੂਰ ਹਾਂ ਹਾਂ ਜ਼ਰੂਰ ਆਊਂਗੀ ਜ਼ਰੂਰ ਮਿਲਣ ਆਊਂਗੀ ਮੈ ਸਪੈਸ਼ਲ ਠੀਕ ਹੈ ਠੀਕ ਹੈ ਠੀਕ ਹੈ